ਸਭ ਤੋਂ ਪਹਿਲਾਂ ਮੈਂ ਇੱਕ ਸੂਤ ਪ੍ਰਦੂਸ਼ਣ ਵਿਰੋਧੀ ਪੌਦੇ ਦੀ ਚੋਣ ਕਰਨ 'ਤੇ ਜੋਰ ਦਿੰਦਾ ਹਾਂ ਉਹ ਪੌਦਾ ਜੋ ਮੇਰੇ ਘਰ ਅਤੇ ਵਾਤਾਵਰਣ ਨੂੰ ਸੁਧਾਰਤਾ ਦਾ ਅਹਿਸਾਸ ਦਿਲਾਉਂਦਾ ਹੈ ਮੈਨੂੰ ਪਸੰਦ ਕਰਦਾ ਹੈ ਇਹ ਪੌਦੇ ਨਾਲ ਹਵਾ ਨੂੰ ਸਾਫ਼ ਰੱਖਣ ਦੇ ਕੰਮ ਵੀ ਕਰਦਾ ਹੈ ਅਚਾਨਕ ਵਾਤਾਵਰਣ ਸ਼ੁੱਧ ਅਤੇ ਤਾਜ਼ਗੀ ਨਾਲ ਭਰ ਦਿੰਦਾ ਹੈ ਇਸ ਨਾਲ ਨਾਲ ਨਾ ਸਿਰਫ਼ ਮੇਰੇ ਆਸ ਪਾਸ ਦੇ ਵਿਚਾਰ ਵਿਚਾਰ ਵਾਲੇ ਭਾਈ ਵੀ ਸਾਰੇ ਖੁਸ਼ ਹੁੰਦੇ ਹਨ ਅਤੇ ਸੁੱਖ ਰਹਿੰਦੇ ਹਨ ਜੇ ਮੈਂ ਕਦੇ ਕਿਸੇ ਸ਼ਹਿਰ ਦੇ ਅੰਦਰ ਜੀਵਨ ਜਿਊਣ ਦੀ ਅਗਵਾਈ ਕੀਤੀ ਤਾਂ ਮੈਂ ਉਹ ਉੱਚਾ ਸੰਚਿਤ ਕਰਨ ਲਈ ਦੇਸ਼ਾਂ ਵਿੱਚ ਵਧੇਰੇ ਫੁੱਲ ਉਗਾਉਣ ਦਾ ਵਿਚਾਰ ਕਰਦਾ ਹਾਂ ਮੇਰੇ ਘਰ ਵਿੱਚ ਗਿਣਤੀ ਗਿਣਤੀ ਵਿੱਚ ਥੋੜ੍ਹਾ ਪੰਜਾਹ ਤੋਂ ਸੱਠ ਪੌਦੇ ਲਗਾਏ ਹਨ ਇਸ ਦੇ ਨਾਲ ਨਾਲ ਮੇਰਾ ਸਾਰਾ ਘਰ ਦਾ ਵਾਤਾਵਰਨ ਸ਼ੁੱਧ ਅਤੇ ਸਾਫ਼ ਰਹਿੰਦਾ ਹੈ ਜਿਸ ਨੂੰ ਲੈ ਕੇ ਘਰ ਦੇ ਵੀ ਖੁਸ਼ ਰਹਿੰਦੇ ਹਨ ਇਹ ਨਾ ਸਿਰਫ ਸ਼ੁੱਧ ਹਵਾ ਮਿਲਦੀ ਹੈ ਬਲਕਿ ਇਹ ਵੀ ਸ਼ਹਿਰ ਦੇ ਚਿਰਪਿੰਗ ਵਾਤਾਵਰਨ ਦੇ ਆਪਸੀ ਸੰਬੰਧਾਂ ਨੂੰ ਸੁਧਾਰਤਾ ਦਾ ਇੱਕ ਹੋਰ ਤਰੀਕਾ ਦਿੰਦੇ ਹਨ ਇਸ ਤਰੀਕੇ ਨਾਲ ਮੈਂ ਆਪਣੇ ਆਸ ਪਾਸ ਦੇ ਸਾਰੇ ਸਹਿਯੋਗੀ ਦੇ ਨਾਲ ਮੇਰੇ ਕ ਇੱਕ ਸ਼ੁੱਧ ਅਤੇ ਖੁਸ਼ਹਾਲ ਵਾਤਾਵਰਨ ਲਾਉਂਦਾ ਹਾਂ ਅਤੇ ਮੇਰੇ ਘਰ ਦੇ ਵੀ ਇਸ ਨੂੰ ਦੇਖ ਕੇ ਖੁਸ਼ ਹੁੰਦੇ ਹਨ